ਮੇਰਾ ਇੱਕ ਦੋਸਤ ਹੈ ਜੋ ਕਿ ਬਲੋਗਰ ਵੀ ਹੈ ਅਤੇ ਉਹ ਵੈਸੇ ਵੀ ਸਾਰੇ ਕਿਤੇ ਘੁੰਮਦਾ ਫਿਰਦਾ ਰਹਿੰਦਾ ਅਤੇ ਉਸਨੇ ਮੈਨੂੰ ਦੱਸਿਆ ਕਿ ਉਹ ਨਾ ਇੰਡੀਆ ਦਾ ਟੂਰ ਕੱਢਿਆ ਸੀ ਉਸਨੇ ਉਸਨੇ ਮੈਨੂੰ ਦੱਸਿਆ ਕਿ ਮੈਂ ਆਗਰੇ 'ਚ ਗਿਆ ਸੀ ਆਗਰੇ 'ਚ ਤਾਜ ਮਹਿਲ ਦੇਖਿਆ ਅਤੇ ਦਿੱਲੀ 'ਚ ਗਿਆ ਸੀ ਦਿੱਲੀ 'ਚ ਲਾਲ ਕਿਲ੍ਹਾ ਦੇਖਿਆ ਉਸ ਤੋਂ ਬਾਅਦ ਕਹਿੰਦਾ ਸੀ ਗੋਆ ਗਿਆ ਗੋਆ ਦੇ ਵਿੱਚ ਬੀਚ ਵਗੈਰਾ ਦੇਖਿਆ ਅਤੇ ਸਮੁੰਦਰਾਂ ਬਾਰੇ ਮੈਨੂੰ ਦੱਸਿਆ ਜੋ ਵੀ ਸੀ ਉੱਥੇ ਅਤੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਡਬਈ ਗਿਆ ਡਬਈ ਦੇ ਵਿੱਚ ਉਹਨੇ ਬੁਰਜ ਖਲੀਫਾ ਦੇਖਿਆ ਉਸ ਬਾਰੇ ਦੱਸਿਆ ਮੈਨੂੰ ਕਿ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਆ ਅਤੇ ਉਸ ਤੋਂ ਬਾਅਦ ਉਹ ਕਨੇਡਾ ਵੀ ਘੁੰਮ ਕੇ ਆਇਆ ਕਨੇਡਾ ਮੈਨੂੰ ਦੱਸ ਰਿਹਾ ਸੀ ਕਿ ਜਿਹੜਾ ਬਰੈਮਟਨ ਸ਼ਹਿਰ ਆ ਕਿ ਉੱਥੇ ਗੋਰਾ ਤਾਂ ਕੋਈ ਵੀ ਨਹੀਂ ਦਿਖ ਰਿਹਾ ਕਿ ਸਾਰੇ ਪੰਜਾਬੀ ਓ ਨੇ ਉੱਥੇ ਵੀ ਆਪਣਾ ਪੰਜਾਬ ਏ ਬਣਿਆ ਪਿਆ ਬਰੈਮਟਨ ਸ਼ਹਿਰ ਤਾਂ ਅਤੇ ਹੋਰ ਵੀ ਮੈਨੂੰ ਬਹੁਤ ਕੁਛ ਦੱਸ ਰਿਹਾ ਸੀ ਇੱਦਾਂ ਹੀ ਬਾਹਰ ਕਈ ਜਗ੍ਹਾ 'ਤੇ ਘੁੰਮ ਕੇ ਆਇਆ ਉਹ